ਸਾਡੇ ਖੇਤਰ ਵਿੱਚ ਮੌਤ ਦਰ ਬਹੁਤ ਹੀ ਘੱਟ ਹੈ ਅਤੇ ਇੱਥੇ ਸਿਹਤ ਸਹੂਲਤਾਂ ਬਹੁਤ ਹੀ ਵਧੀਆਂ ਹਨ ਪਰ ਪਿਛਲੇ ਤੋਂ ਪਿਛਲੇ ਸਾਲ ਜਦੋਂ ਕਰੋਨਾ ਮਹਾਂਮਾਰੀ ਆਈ ਸੀ ਉਦੋਂ ਕੁਝ ਮੌਤਾਂ ਸਾਹਮਣੇ ਆਈਆਂ ਸਨ ਕਿਉਂਕਿ ਉਹ ਬਿਮਾਰੀ ਬਹੁਤ ਹੀ ਭਿਆਨਕ ਬਿਮਾਰੀ ਸੀ ਇਸ ਤੋਂ ਇਲਾਵਾ ਸਾਡੇ ਸ਼ਹਿਰ ਵਿੱਚ ਬੱਚਿਆਂ ਦੇ ਸਮੇਂ ਸਮੇਂ ਸਮੇਂ ਦੌਰਾਨ ਟੀਕਾਕਰਨ ਹੋ ਰਹੇ ਹਨ ਅਤੇ ਸਾਰੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ